ਪੰਜਾਬ ਵਿੱਚ ਪੁਰਾਣੇ ਜ਼ਮਾਨੇ ਵਿੱਚ ਮਰਦ ਅਤੇ ਔਰਤ ਪਹਿਲਾਂ ਪੰਜਾਬ ਮਰਦ ਜੋ ਪੰਜਾਬ ਦੇ ਮਰਦ ਸੀ ਉਹ ਪਹਿਲਾਂ ਧੋਤੀ ਅਤੇ ਕੁੜਤਾ ਪਾਉਂਦੇ ਸੀ ਅਤੇ ਉਹ ਫੁੱਲ ਵਾਲੀ ਪੱਗ ਬੰਨਦੇ ਸੀ ਅਤੇ ਕੁੜਤਾ ਪਜਾਮਾ ਪਾਉਂਦੇ ਸੀ ਅਤੇ ਜੋ ਔਰਤਾਂ ਸੀ ਉਹ ਪੰਜਾਬੀ ਸ ਸਲਵਾਰ ਸੂਟ ਪਾਉਂਦੀਆਂ ਸੀ ਜਾਂ ਘੱਗਰੇ ਵਗੈਰਾ ਲਹਿੰਗੇ ਵਗੈਰਾ ਪਾਉਂਦੀਆਂ ਸੀ ਪਰ ਹੁਣ ਉਹ ਹੋਲੀ ਹੋਲੀ ਇਹ ਜੋ ਪਹਿਰਾਵਾ ਖ਼ਤਮ ਹੋ ਰਿਹਾ ਅਤੇ ਇਹਨਾਂ ਪਹਿਰਾਵਿਆਂ ਨੂੰ ਹੁਣ ਆਮ ਨਹੀਂ ਪਾਇਆ ਜਾਂਦਾ ਹੁਣ ਇਹਨਾਂ ਨੂੰ ਕਈ ਵਾਰ ਕਿਸੇ ਮੌਕੇ ਖਾਸ ਮੋਕੇ ਜਾਂ ਵਿਆਹ ਸ਼ਾਦੀਆਂ 'ਤੇ ਪਾਇਆ ਜਾਂਦਾ ਹੈ ਅਤੇ ਇਹਨਾਂ ਨੂੰ ਹੁਣ ਹੋਰ ਅਲੱਗ ਡਿਜਾਇਨ ਦਿੱਤਾ ਗਿਆ ਹੇੈ ਪਹਿਲਾਂ ਵਾਲੇ ਡਿਜਾਇਨ ਨਹੀਂ ਰਹੇ ਹਨ ਪਹਿਲਾਂ ਜੋ ਪਹਿਰਾਵਾ ਸਾਫ਼ ਸਾਦਾ ਹੁੰਦਾ ਸੀ ਹੁਣ ਓਹੋ ਜਿਹਾ ਪਹਿਰਾਵਾ ਨਹੀਂ ਹੁਣ ਇਹਨਾਂ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਹਨ ਅਤੇ ਇਹਨਾਂ ਨੂੰ ਹੋਰ ਜ਼ਿਆਦਾ ਆਕਰਸ਼ਿਤ ਬਣਾਉਣ ਲਈ ਇਹਨਾਂ ਨੂੰ ਹੋਰ ਜ਼ਿਆਦਾ ਆਕਰਸ਼ਿਤ ਬਣਾਇਆ ਗਿਆ ਹੈ ਅਤੇ ਹੋਰ ਜ਼ਿਆਦਾ ਬਦਲਾਅ ਕਰਕੇ ਇਹਨਾਂ ਨੂੰ ਆਕਰਸ਼ਿਤ ਬਣਾਇਆ ਗਿਆ ਹੈ